ਮੇਰੇ ਮਨਪਸੰਦ ਪੌਦੇ ਅਤੇ ਫੁੱਲ ਕਈ ਹਨ ਮਤਲਬ ਕਿੱਥੇ ਲਗਾਉਣੇ ਹਨ ਉਸ 'ਤੇ ਬਹੁਤ ਡਿਪੈਂਡ ਕਰਦਾ ਜਿੱਦਾਂ ਮੈਂ ਆਪਣੇ ਘਰ 'ਚ ਲਗਾਉਣਾ ਹੋਏ ਕੋਈ ਪੌਦਾਂ ਜਾਂ ਰੁੱਖ ਤਾਂ ਕਿਹੜੀ ਡਰੈਕਸ਼ਨ ਹੈ ਉਹ ਦੇਖ ਕੇ ਪੌਦਾ ਲਗਾਉਣਾ ਚਾਹੂੰਗਾ ਅਤੇ ਉਸ ਹਿਸਾਬ ਨਾਲ ਵੀ ਮੈਨੂੰ ਪੌਦੇ ਪਸੰਦ ਹਨ ਮੈਂ ਘਰ 'ਚ ਇੱਕ ਨਾ ਇੱਕ ਜਿੱਦਾਂ ਫਰੂਟਿੰਗ ਟਰੀ ਜ਼ਰੂਰ ਰੱਖਣਾ ਚਾਹੁੰਦਾ ਹਾਂ ਅਤੇ ਲਗਾਵਾਂਗਾ

ਅਮਰੂਦ ਹੋ ਗਿਆ ਅਨਾਰ ਹੋ ਗਿਆ ਨਿੰਬੂ ਹੋ ਗਿਆ ਇਹਨਾਂ ਦੇ ਪੌਦੇ ਮੈਨੂੰ ਪਸੰਦ ਹਨ ਦਫ਼ਤਰ ਵਿੱਚ ਅਸੀਂ ਕੇਲਿਆਂ ਦੇ ਅਤੇ ਨਿੰਬੂ ਦਾ ਦਰੱਖਤ ਲਗਾਇਆ ਵੀ ਹੋਇਆ ਹੈ ਜਿੱਥੇ ਕੇਲੇ ਅਤੇ ਨਿੰਬੂ ਅਸੀਂ ਖਾਂਦੇ ਵੀ ਹਾਂ ਯੂਜ਼ ਵੀ ਕਰਦੇ ਹਾਂ ਫੁੱਲਾਂ ਨਾਲ ਮੇਰਾ ਬਹੁਤ ਪਰ ਪਰਸਨਲ ਇੱਦਾਂ ਮਤਲਬ ਲਗਾਵ ਤਾਂ ਨਹੀਂ ਹੈ ਕਿਉਂਕਿ ਇਹ ਜਿਹੜੇ ਫਰੂਟ ਵਾਲੇ ਬੂਟਿਆਂ ਨੂੰ ਉਹਨਾਂ 'ਚ ਵੀ ਕਈਆਂ 'ਚ ਫੁੱਲ ਆਉਂਦੇ ਹਨ ਅਤੇ ਸੀਜ਼ਨਲ ਅਤੇ ਕਦੀ ਕਦੀ ਉਹ ਚੰਗੇ ਲੱਗਦੇ ਹਨ ਬਾਕੀ ਉਂਜ ਈ ਫੁ ਫਲਾਵਰ ਵਾਲੇ ਬੂਟੇ ਬਸ ਕਿਉਂਕਿ ਉਹਨਾਂ ਦੀ ਬਸ ਵਿਜ਼ੂਅਲੀ ਇਕ ਸੁੰਦਰਤਾ ਹੁੰਦੀ ਹੈ ਦੇਖਣ 'ਚ ਹੀ ਬਸ ਸੁੰਦਰਤਾ ਹੁੰਦੀ ਹੈ ਅਤੇ ਉਹ ਜਿਹੇ ਤਾਂ ਮੇਰੇ ਬਹੁਤ ਮਨਪਸੰਦ ਨਹੀਂ ਹਨ ਬਾਕੀ ਅ ਪੋਗਨ ਵੇਲੇ ਪਸੰਦ ਹੈ ਵੈਸੇ ਦੇਖਿਆ ਜਾਏ ਅਗਰ ਸਜਾਵਟ ਲਈ ਚਾਹੀਦੀ ਹੋਵੇ ਕਿਉਂਕਿ ਉਹਦੀ ਮੈਂਟੇਨੈਂਸ ਬਹੁਤ ਘੱਟ ਆ ਉਹਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ ਅਤੇ ਮੈਂ ਉਹ ਉਹ ਫੁੱਲਾਂ ਵਾਲਾ ਬੂਟਾ ਪਸੰਦ ਕਰਦਾ ਹਾਂ ਇੱਕ ਵਾਰੀ ਲੱਗ ਜਾਏ ਤਾਂ ਕਾਫੀ ਸੌਖਾ ਹੈ ਉਹ ਨੂੰ ਸੰਭਾਲਣਾ ਬਾਕੀ ਫਰੂਟਸ ਤਾਂ ਹੋਰ ਵੀ ਕਾਫੀ ਹਨ ਜਿਹੜੇ ਕਿ ਅਮਰੂਦ ਹੋ ਗਏ ਅੰਬ ਹੋ ਗਏ ਜਿਹੜੇ ਕਿ ਕਿਤੇ ਮਿਲ ਜਾਣ ਅਤੇ ਜਾਂ ਮੌਕਾ ਮਿਲੇ ਕਿਸ ਕਿਤੇ ਲਗਾਉਣ ਦਾ ਤਾਂ ਅਸੀਂ ਜ਼ਰੂਰ ਪਸੰਦ ਕਰਦੇ ਹਾਂ ਕੁਛ ਬੂਟੇ ਜਿਹੜੇ ਕਿ ਹੁੰਦੇ ਹਨ ਅਸੀਂ ਸਾਊਥ ਵੱਲ ਦਿਸ਼ਾ ਵੱਲ ਲਾਉਣੇ ਪਸੰਦ ਕਰਦੇ ਹਾਂ ਉਹ ਹੁੰਦੇ ਹਨ ਡਿਸਊਡਸਟੀ ਜਿਹਨੂੰ ਕਹਿੰਦੇ ਜਿਹੜੇ ਝੜ ਜਾਂਦੇ ਹਨ ਸਰਦੀਆਂ 'ਚ ਜਿਉਂ ਝੜਦੇ ਹਨ ਅਤੇ ਉਹ ਧੁੱਪ ਨੂੰ ਬੜਾ ਵਧੀਆ ਆਉਣ ਦਿੰਦੇ ਹਨ ਥੱਲੇ ਤੱਕ ਅਤੇ ਗਰਮੀਆਂ 'ਚ ਉਹ ਬੜਾ ਵਧੀਆ ਇੱਦਾਂ ਕੰਮ ਕਰਦੇ ਹਨ ਕਿ ਪੂਰਾ ਪੱਤਿਆਂ ਨਾਲ ਮਤਲਬ ਗਰੀਨ ਹੋ ਜਾਂਦੇ ਹਨ ਹਰੇ ਹੋ ਜਾਂਦੇ ਹਨ ਕਿ ਧੁੱਪ ਬਿਲਕੁਲ ਤਰ੍ਹਾਂ ਰੋਕ ਦਿੰਦੇ ਹਨ ਬਸ ਇੱਦਾਂ ਜਗ੍ਹਾ ਅਤੇ ਮਾਹੌਲ ਦੇਖ ਕੇ ਅਸੀਂ ਬੂਟੇ ਪਸੰਦ ਕਰਦੇ ਹਾਂ ਅਤੇ ਲਗਾਉਂਦੇ ਹਾਂ ਅਤੇ ਇੱਦਾਂ ਹੀ ਬੂਟਿਆਂ ਦੀ ਥੋੜ੍ਹੀ ਪਸੰਦ ਵੀ ਹੈ ਬਾਕੀ ਗੁਲਮੋਹਰ ਜਕਰਾਂਡਾ ਟਰਮੀਨੇਲੀਆ ਸੋਅੰਜਣਾ ਇਹ ਕੁਛ ਹੋਰ ਨਾਮ ਨਾ ਜੋ ਬੂਟੇ ਮੈਨੂੰ ਪਸੰਦ ਹਨ ਅਤੇ ਅਸੀਂ ਲਗਾਏ ਹਨ ਜਾਂ ਲਗਾਉਂਦੇ ਹਾਂ